ਭੋਜਨ ਨਾਲ ਸੰਬੰਧਿਤ ਵੱਖ ਵੱਖ ਪਰੰਪਰਾਵਾਂ ਹਨ ਜਿਵੇਂ ਪੰਜਾਬੀ ਲੋਕ ਜਦੋਂ ਭੋਜਨ ਛਕਦੇ ਆ ਤਾਂ ਉਹ ਪਹਿਲਾਂ ਮਤ ਭੋਜਨ ਛ ਭੋਜਨ ਛਕਦੇ ਆ ਤਾਂ ਉਹ ਪਹਿਲਾਂ ਰੱਬ ਅੱਗੇ ਪ੍ਰਾਰਥਨਾ ਅਰਦਾਸ ਕਰਦੇ ਆ ਉਹਦਾ ਸ਼ੁਕਰਾਨਾ ਕਰਦੇ ਆ ਫੇਰ ਖਾਣ ਤੋਂ ਬਾਅਦ ਵੀ ਉਹਦਾ ਸ਼ੁਕਰਾਨਾ ਕਰਦੇ ਆ ਪੰਜਾਬੀ ਲੋਕ ਗੁਰਦੁਆਰੇ ਸਾਹਿਬ ਦੇ ਵਿੱਚ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕਣਾ ਉਹਨਾਂ ਨੂੰ ਚੰਗਾ ਸਮਝਿਆ ਜਾਂਦਾ ਕਿਉਂਕਿ ਉੱਥੇ ਸਾਰੇ ਧਰਮਾਂ ਦੇ ਲੋਕ ਬਰਾਬਰ ਬੈਠ ਕੇ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕਦੇ ਆ ਦੂਸਰਾ ਸਿਰ ਢੱਕ ਕੇ ਲੰਗਰ ਛਕਿਆ ਜਾਂਦਾ ਹਿੰਦੂ ਧਰਮ ਦੇ ਵਿੱਚ ਲੋਕ ਜਿਹੜੇ ਆ ਉਹ ਜ਼ਮੀਨ 'ਤੇ ਬੈਠ ਕੇ ਭੋਜਨ ਛਕਦੇ ਆ ਉਹ ਮਤਲਬ ਗਊਆਂ ਨੂੰ ਪ ਮੰਗਲਵਾਰ ਪੇੜਾ ਦੇਣਾ ਵੀ ਚੰਗਾ ਸਮਝਦੇ ਆ ਉਹ ਪਿੱਤਰਾਂ ਨੂੰ ਵੀ ਭੋਜਨ ਖਵਾਉਂਦੇ ਆ ਅਤੇ ਜਿਸ ਤਰ੍ਹਾਂ ਮੁਸਲਮਾਨ ਲੋਕ ਹੋ ਗਏ ਤਾਂ ਉਹ ਵੀ ਉਹਨਾਂ ਦਾ ਵੀ ਧਰਮ ਅਲੱਗ ਹੈ ਉਹ ਆਪਣਾ ਭੋਜਨ ਜਿਸ ਤਰ੍ਹਾਂ ਈਦ ਵਾਲੇ ਦਿਨ ਉਹ ਸੇਵੀਆਂ ਬਣਾਉਂਦੇ ਆ ਬਕਰੀਦ ਹੁੰਦੀ ਆ ਉਹ ਬੱਕਰੇ ਵੱਢਦੇ ਆ ਮਾਸ ਖਾਂਦੇ ਆ ਇਸ ਤਰ੍ਹਾਂ ਭੋਜਨ ਨਾਲ ਸੰਬੰਧਿਤ ਵੱਖੋ ਵੱਖਰੇ ਧਰਮ ਨੇ ਵੱਖੋ ਵੱਖ ਧਰਮਾਂ ਦੇ ਆਪਣੇ ਪਰੰਪਰਾਵਾਂ ਨੇ ਆਪਣੇ ਹੀ ਅੰਧ ਵਿਸ਼ਵਾਸ ਨੇ ਜੋ ਕਿ ਖਾਣਾ ਪਕਾਉਣ ਦੇ ਸਮੇਂ ਖਾਣ ਦੇ ਸਮੇਂ ਅਪਣਾਏ ਜਾਂਦੇ ਹਨ